ਹਾਂ ਡਾਂਸ ਕਰਦੇ ਲੋਕਾਂ ਖੁਸ਼ੀ ਮਹਿਸੂਸ ਕਰਦੇ ਹਨ ਡਾਂਸ ਕਰਨ ਨਾਲ ਡਾਂਸ ਬਹੁਤ ਪ੍ਰਕਾਰ ਦੇ ਹਨ ਗਿੱਧੇ ਭੰਗੜੇ ਔਰ ਵੀ ਹਨ ਜੋ ਕਿ ਡਾਂਸ ਕਰਨ ਨਾਲ ਬਹੁਤ ਹੀ ਸਰੀਰ ਨੂੰ ਤੰਦਰੁਸਤੀ ਮਹਿਸੂਸ ਹੁੰਦੀ ਹੈ ਅਤੇ ਦਿਮਾਗ ਨੂੰ ਫਰੈਸ਼ ਫੀਲ ਹੁੰਦਾ ਹੈ ਡਾਂਸ ਕਰਨ ਨਾਲ ਸਾਡੇ ਸਰੀਰ ਵਿੱਚ ਲਚਕੀਲਾਪਨ ਆਉਂਦਾ ਹੈ ਜਿਸ ਕਰਕੇ ਅਸੀਂ ਸਾਡੇ ਸਕਿੱਲ ਸਾਡਾ ਸਰੀਰ ਸਾਡਾ ਸਰੀਰ ਹਲਕਾ ਮਹਿਸੂਸ ਕਰਦਾ ਹੈ ਅਤੇ ਅਸੀਂ ਹਰ ਕੰਮ ਨੂੰ ਕਰਨ ਨੂੰ ਆਸਾਨੀ ਨਾਲ ਕਰ ਸਕਦੇ ਨੇ ਅਤੇ ਡਾਂਸ ਸਾਨੂੰ ਮਾਨਸਿਕ ਤੰਦਰੁਸਤ ਕਰਦਾ ਹੈ ਅਤੇ ਸਰੀਰਕ ਤੰਦਰੁਸਤ ਕਰਨਾ ਹੈ ਕਰਦਾ ਹੈ ਡਾਂਸ ਨਾਲ ਅਸੀਂ ਹਰ ਪਾਰਟੀ ਫੰਕਸ਼ਨ ਵਿੱਚ ਵੀ ਕਰਦੇ ਨੇ ਡਾਂਸ ਨੂੰ ਹਰ ਖੁਸ਼ੀ ਦੇ ਮੌਕੇ ਉੱਪਰ ਕੀਤਾ ਜਾਂਦਾ ਹੈ